ਹੈਲੋ ਸਰ ਦਸ਼ਮੇਸ਼ ਨਰਸਰੀ ਤੋਂ ਬੋਲ ਰਹੇ ਹੋ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਸਤਪਿੰਦਰ ਸਿੰਘ ਬੋਲ ਰਿਹਾ ਜੀ ਪਟਿਆਲੇ ਤੋਂ ਸਰ ਮੈਨੂੰ ਥੋੜ੍ਹੀ ਜੀ ਫਲਾਰਸ ਬਾਰੇ ਇਨਫੋਰਮੇਸ਼ਨ ਚਾਹੀਦੀ ਸੀ ਤੁਹਾਡੇ ਕੋਲ ਟਾਈਮ ਹੈ ਸਰ ਫਰੀ ਹੋ ਤੁਸੀਂ ਸਰ ਮੈਂ ਆਪਣਾ ਮੈਂ ਆਪਣੇ ਘਰ 'ਚ ਇੱਕ ਛੋਟਾ ਜਿਹਾ ਗਾਰਡਨ ਬਣਾ ਰਿਹਾ ਅਤੇ ਮੈਨੂੰ ਗਾਰਡਨ 'ਚ ਨਾ ਮਤਲਬ ਇੱਕ ਤਾਂ ਫਲਾਰ ਹੁੰਦੇ ਹੈ ਇੱਕ ਤਾਂ ਸੀਜ਼ਨਲ ਹੁੰਦੇ ਹੈ ਅਤੇ ਇੱਕ ਲੋਂਗ ਰਨ ਫਲਾਰਸ ਹੁੰਦੇ ਆ ਜਿਹੜੇ ਪੱਕਾ ਬੂਟਾ ਹਾਂਜੀ ਮੈਨੂੰ ਉਹ ਚਾਹੀਦੇ ਆ ਅਤੇ ਮੈਨੂੰ ਗਾਈਡ ਕਰਦੋ ਵੀ ਇੱਕ ਤਾਂ ਕਿਹੜਾ ਫਲਾਰ ਲਾ ਸਕਦੇ ਹਾਂ ਅਤੇ ਕਿੱਥੋਂ ਮਿਲ ਸਕਦੇ ਆ ਅੱਛਾ ਜੀ ਗੁਲਾਬ ਦੀਆਂ ਵੀ ਕਿਸਮਾਂ ਹੁੰਦੀਆਂ ਨੇ ਸਰ ਆਪਾਂ ਕਿਹੜਾ ਲਾਈਏ ਹਾਂਜੀ ਠੀਕ ਹੈ ਜੀ ਸਰ ਹਾਂਜੀ ਮੈਂ ਇਹੀ ਪੁੱਛਣਾ ਸੀ ਮਤਲਬ ਐਸਾ ਹੀ ਫਲਾਰ ਚਾਹੀਦਾ ਮੈਨੂੰ ਜਿਹੜਾ ਲੋੜ ਪੈਣ 'ਤੇ ਆਪਾਂ ਐਜ਼ ਆ ਮੈਡੀਸਨ ਵੀ ਆਪਾਂ ਯੂਸ ਕਰ ਸਕਦੇ ਹਾਂ ਉਹਨੂੰ ਅੱਛਾ ਅਤੇ ਸਰ ਮੈਨੂੰ ਗਾਈਡ ਕਰ ਦਿਓ ਕਿ ਮੈਨੂੰ ਕਿੱਥੋਂ ਮਿਲ ਸਕਦਾ ਹੈ ਵਧੀਆ ਫੁਆਰਾ ਚੌਂਕ ਤੋਂ ਮਿਲਜੂ ਵੈਸੇ ਠੀਕ ਹੈ ਜੀ ਓਕੇ ਅਤੇ ਮੈਨੂੰ ਸਰ ਇੱਕ ਹੋਰ ਗਾਈਡ ਕਰੋ ਕਿ ਇਹਨਾਂ ਨੂੰ ਮਤਲਬ ਇਹ ਜਿਹੜਾ ਹੁਣ ਟਾਈਮ ਚੱਲ ਰਿਹਾ ਹੈ ਇਹ ਟਾਈਮ ਠੀਕ ਹੈ ਇਹਨਾਂ ਨੂੰ ਲਗਾਉਣ ਵਾਸਤੇ ਜਾਂ ਮਤਲਬ ਕੋਈ ਸਪੈਸੀਫਿਕ ਠੀਕ ਹੈ ਜੀ ਓਕੇ ਅਤੇ ਸਰ ਇਸ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਆਪਾਂ ਖਾਦਾਂ ਜਿਹੜੀ ਹੈਗੀਆਂ ਆਪਾਂ ਯੂਸ ਕਰ ਸਕ ਯੂਸ ਕਰਨੀਆਂ ਚਾਹੀਦੀਆਂ ਗੁਲਾਬ ਨੂੰ ਮਤਲਬ ਵਧੀਆ ਗਰੋਥ ਦੇਣ ਲਈ ਅਤੇ ਕਿੰਨੇ ਕਿੰਨੇ ਟਾਈਮ ਬਾਅਦ ਪਾਉਣੀ ਚਾਹੀਦੀ ਆ ਜੀ ਆਪਾਂ ਨੂੰ

ਅੱਛਾ ਠੀਕ ਹੈ ਸਰ ਠੀਕ ਹੈ ਜੀ ਸ਼ੁਕਰੀਆ ਠੀਕ ਹੈ ਥੈਂਕ ਯੂ ਸਰ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਓਕੇ ਜੀ ਓਕੇ